ਮੈਨੇ ਜ਼ਿੰਦਗੀ ਵਿੱਚ ਖੂਹ ਤਾਂ ਵੇਖੇ ਹਨ ਪਰ ਕਦੀ ਵੀ ਕਿਸੇ ਨੂੰ ਵੀ ਖੂਹ ਵਿੱਚੋਂ ਪਾਣੀ ਕੱਢਦੇ ਨਹੀਂ ਦੇਖਿਆ ਉਹ ਸਿਰਫ਼ ਮੈਨੇ ਫਿਲਮਾਂ ਵਿੱਚ ਹੀ ਵੇਖਿਆ ਹੈ ਕਿ ਖੂਹ ਵਿੱਚ ਰੱਸੀ ਗੇਰ ਕੇ ਪਾਣੀ ਕੱਢਿਆ ਜਾਂਦਾ ਸੀ ਉਹ ਪੁਰਾਣੇ ਸਮੇਂ ਵਿੱਚ ਕੀਤਾ ਜਾਂਦਾ ਸੀ ਅੱਜ ਕੱਲ੍ਹ ਦੇ ਸਮੇਂ ਵਿੱਚ ਖੂਹ ਬੰਦ ਕੀਤੇ ਜਾ ਚੁੱਕੇ ਹਨ ਸਾਨੂੰ ਬਹੁਤ ਘੱਟ ਖੂਹ ਵੇਖਣ ਨੂੰ ਮਿਲਦੇ ਹਨ ਅੱਜ ਕੱਲ੍ਹ ਲੋਕਾਂ ਨੇ ਕਈ ਬੋਰਵੈੱਲ ਲਗਾ ਲਏ ਹਨ ਜੋ ਕਿ ਸਿਰਫ਼ ਸਾਨੂੰ ਪਿੰਡਾਂ ਦੇ ਖੇਤਾਂ ਵਿੱਚ ਹੀ ਦੇਖਣ ਨੂੰ ਮਿਲਦੇ ਹਨ ਬੋਰਵੈੱਲ ਰਾਹੀਂ ਅਸੀਂ ਧਰਤੀ ਦੇ ਹੇਠਾਂ ਤੋਂ ਮਸ਼ੀਨ ਰਾਹੀਂ ਪਾਣੀ ਉੱਪਰ ਲੈ ਕੇ ਆਉਂਦੇ ਹਾਂ ਇਸ ਚੀਜ਼ ਰਾਹੀਂ ਹੀ ਪਾਣੀ ਨੂੰ ਉੱਪਰ ਲਿਆਂਦਾ ਜਾਂਦਾ ਹੈ ਇਹ ਸਾਰਾ ਪਾਣੀ ਖੇਤਾਂ ਵਿੱਚ ਪਹੁੰਚਾਇਆ ਜਾਂਦਾ ਹੈ ਅਤੇ ਕਈ ਘਰਾਂ ਵਿੱਚ ਵੀ ਇਹ ਪਾਣੀ ਪਹੁੰਚਾਇਆ ਜਾਂਦਾ ਹੈ